ਸਾਡੇ ਸਥਾਨ ਤੋਂ ਬਹੁਤ ਸਾਰੇ ਖੇਡ ਸ਼ਖਸ਼ੀਅਤ ਅਤੇ ਐਥਲੀਟ ਹਨ ਜਿਨ੍ਹਾਂ ਨੇ ਆਪੋ ਆਪਣੀਆਂ ਖੇਡਾਂ ਵਿੱਚ ਛਾਪ ਛੱਡੀ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਸਰਦਾਰ ਕਰਤਾਰ ਸਿੰਘ ਦੀ ਜੋ ਕਿ ਕੁਸ਼ਤੀ ਦੇ ਬਹੁਤ ਹੀ ਵੱਡੇ ਪਹਿਲਵਾਨ ਹਨ ਜਿਨ੍ਹਾਂ ਨੇ ਆਪਣਾ ਜਗ੍ਹਾ ਜਗ੍ਹਾ 'ਤੇ ਨਾਮ ਰੌਸ਼ਨ ਕੀਤਾ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮਾਣ ਸਨਮਾਨ ਪ੍ਰਾਪਤ ਕੀਤਾ ਜੇ ਆਪਾਂ ਗੱਲ ਕਰੀਏ ਜੱਸਾ ਭੱਟੀ ਦੀ ਜੋ ਕਿ ਕੁਸ਼ਤੀ ਦੇ ਬਹੁਤ ਹੀ ਵੱਡੇ ਪਹਿਲਵਾਨ ਹਨ ਉਹਨਾਂ ਨੇ ਵੀ ਪੰਜਾਬ ਵਿੱਚ ਬਹੁਤ ਸਾਰੇ ਮੇਲੇ ਅਤੇ ਬਹੁਤ ਸਾਰੇ ਮੇਲੇ ਅਤੇ ਬਹੁਤ ਸਾਰੀਆਂ ਜਗ੍ਹਾ ਤੋਂ ਨਾਮ ਸਨਮਾਨ ਪ੍ਰਾਪਤ ਕੀਤਾ ਜੇ ਆਪਾਂ ਗੱਲ ਕਰੀਏ ਕਬੱਡੀ ਦੀ ਤਾਂ ਕਬੱਡੀ ਵਿੱਚ ਸੰਦੀਪ ਨੰਗਲ ਜੋ ਕਿ ਬਹੁਤ ਹੀ ਵੱਡੇ ਖਿਡਾਰੀ ਹਨ ਜਿਨ੍ਹਾਂ ਨੇ ਸਥ ਜਿਨ੍ਹਾਂ ਨੇ ਥਾਂ ਥਾਂ 'ਤੇ ਬੱਚਿਆਂ ਨੂੰ ਜਾ ਕੇ ਸਿੱਖਿਆ ਦਿੱਤੀ ਅਤੇ ਉਹਨਾਂ ਨੂੰ ਸਮਝਾਇਆ ਕਿ ਕਬੱਡੀ ਬਹੁਤ ਹੀ ਵੱਡੀ ਵਧੀਆ ਕਬੱਡੀ ਬਹੁਤ ਹੀ ਵਧੀਆ ਗੇ ਖੇਡ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਸਰਦਾਰ ਜਰਮਨਜੀਤ ਸਿੰਘ ਜੋ ਕਿ ਫੁੱਟਬਾਲ ਦੇ ਕੋਚ ਹਨ ਜਿਨ੍ਹਾਂ ਨੇ ਸਾਡੀ ਜਿਨ੍ਹਾਂ ਦਾ ਨਾਮ ਸਾਡੇ ਇਲਾਕੇ ਵਿੱਚ ਬਹੁਤ ਹੀ ਮਸ਼ਹੂਰ ਹੈ ਹਾਂ ਇਹਨਾਂ ਨੇ ਸਰਕਾਰ ਤੋਂ ਬਹੁਤ ਸਾਰੇ ਨਾਮ ਇਨਾਮ ਪ੍ਰਾਪਤ ਕੀਤੇ ਅਤੇ ਕਈ ਅਤੇ ਸਾਡੇ ਦੇਸ਼ ਦਾ ਨਾਮ ਰੌਸ਼ਨ ਸਾਡੇ ਦੇਸ਼ ਦਾ ਨਾਮ ਰੌਸ਼ਨ ਕੀਤਾ